ਪੰਜਾਬੀ ਭਾਸ਼ਾ ਦੀਆਂ ਕੁਝ ਵਿਲੱਖਣ ਵਿਸ਼ੇਸ਼ਤਾਵਾਂ ਹਨ ਕਿ ਜਿਵੇਂ ਇਹ ਸਾਡੀ ਇੱਕ ਮਾਤ ਬੋਲੀ ਹੈ ਆਪਾਂ ਸ਼ੁਰੂ ਤੋਂ ਹੀ ਇਹ ਬੋਲਣਾ ਸਟਾਰਟ ਕੀਤੀ ਹੈ ਸਾਡੇ ਵੱਡੇ ਘਰਦਿਆਂ ਨੂੰ ਵੀ ਉਹ ਵੀ ਪਹਿਲੇ ਪੰਜਾਬੀ ਵਿੱਚ ਹੀ ਗੱਲ ਕਰਦੇ ਸਨ ਅਤੇ ਉਹਨਾਂ ਨੂੰ ਵੀ ਸਾਨੂੰ ਪੰਜਾਬੀ ਹੀ ਇਹ ਸਿਖਾਈ ਹੈ ਅਤੇ ਪੰਜਾਬੀ ਭਾਸ਼ਾ ਬੋਲਣ ਵਿੱਚ ਵੀ ਬਹੁਤ ਹੀ ਵਧੀਆ ਲੱਗਦੀ ਹੈ ਕਿ ਇਹ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਅਤੇ ਉਹਦੇ ਵਿੱਚ ਪੂਰਾ ਆਦਰ ਸਤਿਕਾਰ ਸਭ ਕੁਛ ਨਜ਼ਰ ਆਉਂਦਾ ਆ ਆਪਾਂ ਵੱਡਿਆਂ ਦਾ ਆਦਰ ਕਰਦੇ ਹਾਂ ਅਤੇ ਜਿਵੇਂ ਪੰਜਾਬੀ ਭਾਸ਼ਾ ਜਿਵੇਂ ਇੱਕ ਮਾਝਾ ਦੁਆਬਾ ਮਲਵਈ ਇਹ ਹੈਗੇ ਆ ਪੰਜਾਬੀ ਦੀਆਂ ਹ ਅਲੱਗ ਅਲੱਗ ਤਰ੍ਹਾਂ ਦੇ ਹੀ ਵਿਸ਼ੇਸ਼ਤਾਵਾਂ ਹੈਗੀਆਂ ਹਨ ਅਤੇ ਪੰਜਾਬੀ ਭਾਸ਼ਾ ਆਪਾਂ ਸ਼ੁਰੂ ਤੋਂ ਹੀ ਬੋਲਦੇ ਆ ਰਹੇ ਹਾਂ ਅਤੇ ਪੰਜਾਬੀ ਭਾਸ਼ਾ ਮਤਲਬ ਸ ਪੜ੍ਹਨ ਵਿੱਚ ਵੀ ਬਹੁਤ ਹੀ ਜ਼ਿਆਦਾ ਵਧੀਆ ਸੌਖੀ ਵੀ ਲੱਗਦੀ ਹੈ ਅਤੇ ਆਪਾਂ ਪੰਜਾਬੀ ਭਾਸ਼ਾ ਨਾਲ ਆਪਣੇ ਗੁਰੂਆਂ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਜਿਵੇਂ ਗੁਰਮੁਖੀ ਵਿੱਚ ਪਾਠ ਵਗੈਰਾ ਹੁੰਦੇ ਆਪਾਂ ਈਜ਼ੀਲੀ ਆਪਾਂ ਉਹਨਾਂ ਨੂੰ ਪੜ੍ਹ ਸਕਦੇ ਹਾਂ ਅਤੇ ਅਤੇ ਹੋਰ ਵੀ ਬਹੁਤ ਸਾਰੇ ਜੋ ਪੰਜਾਬੀ ਵਿੱਚ ਸਾਡੇ ਗੁਰੂਆਂ ਦੀ ਬਾਣੀ ਹੈਗੀਆਂ ਆਪਾਂ ਉਹਨੂੰ ਬਹੁਤ ਹੀ ਸੌਖੇ ਅਤੇ ਆਸਾਨ ਤਰੀਕੇ ਨਾਲ ਪੜ੍ਹ ਸਕਦੇ ਹਾਂ ਅਤੇ ਪੰਜਾਬੀ ਭਾਸ਼ਾ ਦੀਆਂ ਬਹੁਤ ਹੀ ਜ਼ਿਆਦਾ ਵਿਸ਼ੇਸ਼ਤਾਵਾਂ ਹੈਗੀਆਂ ਪਰ ਮੁੱਖ ਵਿਸ਼ੇਸ਼ਤਾ ਇਹੀ ਹੈ ਕਿ ਜਦੋਂ ਆਪਾਂ ਕਿਸੇ ਦੇ ਨਾਲ ਗੱਲ ਕਰਦੇ ਹਾਂ ਤਾਂ ਆਪਣੇ ਗੱਲ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਦੇ ਅੱਗੇ ਰੱਖ ਲੈਂਦੇ ਹਾਂ ਬਹੁਤ ਹੀ ਆਦਰ ਸਤਿਕਾਰ ਦੇ ਨਾਲ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਇਹੀ ਸਾਡੀ ਪੰਜਾਬੀ ਭਾਸ਼ਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੈਗੀਆਂ